ਹੈਲੋ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਯਾਨੀ ਕਿ ਮੈਂ ਨਾ ਤੁਹਾਨੂੰ ਪੁੱਛਣਾ ਸੀਗਾ ਮੈਂ ਆਈ ਹਾਂ ਰੋਪੜ ਤੋਂ ਅਤੇ ਇੱਥੇ ਦਰਬਾਰ ਸਾਹਿਬ ਵਿਖੇ ਹਾਂਜੀ ਦਰਸ਼ਨ ਲਈ ਆਈ ਸੀਗੀ ਅਤੇ ਮੈਂ ਹਾਂਜੀ ਅਤੇ ਮਤਲਬ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਇੱਥੇ ਅਸੀਂ ਲੰਗਰ ਦੀ ਸੇਵਾ ਮਤਲਬ ਕਿਵੇਂ ਕਰ ਸਕਦੇ ਹਾਂ ਜਾਂ ਕੋਈ ਹੋਰ ਸੇਵਾ ਜਿਹੜੀ ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ

ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ